ਹੈਲੋ ਹਾਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਕੀ ਹੋਇਆ ਜੀ ਹਾਂਜੀ ਅੱਛਾ ਕਿੰਨੇ ਕੁ ਦਿਨ ਹੋ ਗਏ ਜੀ ਇਹ ਹੋਏ ਨੂੰ ਹਾਂਜੀ ਹਾਂਜੀ ਅੱਛਾ ਠੀਕ ਆ ਅਤੇ ਕੀ ਕਹਿੰਦੇ ਆ ਗਲਾ ਵਗੈਰਾ ਵੀ ਤੁਹਾਡਾ ਖ਼ਰਾਬ ਆ ਅੱਛਾ ਅੱਛਾ ਇਹ ਮੌਸਮ ਕਰਕੇ ਹੋ ਰਿਹਾ ਜ਼ਿਆਦਾਤਰ ਕਾਫੀ ਲੋਕਾਂ ਦੀ ਇਸ ਟਾਈਮ ਸਮੱਸਿਆ ਆ ਰਹੀ ਹੈ ਅਤੇ ਆਪਾਂ ਕੀ ਕਹਿ ਤੁਸੀਂ ਕੋਈ ਦਵਾਈ ਵਗੈਰਾ ਲਈ ਹੈ ਤੁਸੀਂ ਕੋਈ ਦਵਾਈ ਵਗੈਰਾ ਲਈ ਆ ਹਾਂਜੀ ਹਾਂਜੀ ਫ਼ਰਕ ਨਹੀਂ ਪਿਆ ਤੁਹਾਨੂੰ ਇਹਨਾਂ ਨੂੰ ਫ਼ਰਕ ਨਹੀਂ ਪਿਆ ਅੱਛਾ ਠੀਕ ਹੈ ਕੋਈ ਗੱਲ ਨਹੀਂ ਆਪਾਂ ਕੀ ਕਹਿੰਦੇ ਆ ਤੁਹਾਨੂੰ ਪਹਿਲਾਂ ਕੋਈ ਬਿਮਾਰੀ ਸੀਗੀ ਇੱਦਾਂ ਨਈ ਹਾਲ 'ਚ ਕੋਈ ਸਹੀ ਹੋਈ ਹੋਵੇ ਅੱਛਾ ਕੋਵਿਡ ਹੋਇਆ ਸੀ ਤੁਹਾਨੂੰ ਹਾਂ ਹਾਂ ਉਹ ਕੋਵਿਡ ਦਾ ਆਫਟਰ ਸਿਮਟਮ ਨਾ ਜਿਹੜੀ ਆਪਣੀ ਵੈਕਸੀਨ ਤੁਹਾਡੀ ਕੋਵੈਕਸੀਨ ਤੁਸੀਂ ਲਵਾਈ ਹੋਣੀ ਆ ਹਾਂਜੀ ਇਹ ਉਸ ਕਰਕੇ ਵੀ ਬਹੁਤ ਵਾਰ ਹੁੰਦਾ ਬਹੁਤ ਲੋਕਾਂ ਨਾਲ ਹੋ ਰਿਹਾ ਆ ਤੁਸੀਂ ਨਿਸ਼ਚਿੰਤ ਹੋ ਜਾਓ ਕੋਈ ਵੱਡੀ ਚਿੰਤਾ ਕਰਨ ਵਾਲੀ ਗੱਲ ਨਹੀਂ ਹੈਗੀ ਨਹੀਂ ਨਹੀਂ ਨਹੀਂ ਉਹ ਆਪਣੀ ਸਾਰੀ ਹੋ ਰਹੀ ਉਹ ਮੌਸਮ ਤੁਹਾਨੂੰ ਪਤਾ ਗਰਮੀ ਸਰਦੀ ਦਾ ਮਿਕਸ ਜਿਹਾ ਮੌਸਮ ਹੈ ਉਹ ਇਸ ਕਾਰਨ ਹੀ ਸਰੀਰ ਦੇ ਦਾਨੇ ਵਗੈਰਾ ਹੋ ਰਹੇ ਆ ਉਹਦਾ ਆਪਣਾ ਕੋਈ ਨਹੀਂ ਦਵਾਈ ਮੈਂ ਤੁਹਾਨੂੰ ਦੱਸ ਦਿੰਨਾ ਤੁਸੀਂ ਦਵਾਈ ਵਗੈਰਾ ਲਓ ਥੋੜ੍ਹੇ ਦਿਨ ਲਈ ਅਤੇ ਤੁਸੀਂ ਸਹੀ ਹੋ ਜਾਓਗੇ ਤੁਸੀਂ ਬਿਲਕੁਲ ਪ੍ਰਵਾਹ ਨਾ ਕਰੋ ਤੁਸੀਂ ਬਸ ਆਪਣਾ ਖਾਣਾ ਖੁਣਾ ਆਪਾਂ ਲੈਣਾ ਵਧੀਆ ਠੀਕ ਹੈ ਆਪਾਂ ਖਾਣਾ ਖੁਣਾ ਵਧੀਆ ਲੈਣਾ ਜਿੱਦਾਂ ਕਿ ਸੂਪ ਵਗੈਰਾ ਪੀਓ ਲਿਕੁਅਡ ਚੀਜ਼ਾਂ ਜ਼ਿਆਦਾ ਲਓ ਭਾਰੀ ਖਾਣਾ ਨਹੀ ਖਾਣਾ ਆਪਾਂ ਕਿਉਂਕਿ ਆਪਣਾ ਪੇਟ ਨਾ ਪੇਟ ਖ਼ਰਾਬ ਹੋਣ ਦੇ ਵੀ ਕਾਫੀ ਹੁੰਦੇ ਆ ਕੀ ਕਹਿਣਾ ਤਾਂ ਹਾਂਜੀ ਉਹ ਹੀ ਮੈਂ ਕਹਿ ਰਿਹਾ ਤੁਹਾਨੂੰ ਉਹ ਹੀ ਮੈਂ ਤੁਹਾਨੂੰ ਕਹਿ ਰਿਹਾ ਇਹ ਇਸ ਦਾ ਹੀ ਇਫੈਕਟ ਹੈ ਆਪਾਂ ਖਾਣਾ ਖਾਣਾ ਬਿਲਕੁਲ ਹਲਕਾ ਜਿੱਦਾਂ ਆਪਣੀ ਹਰੀ ਸਬਜ਼ੀਆਂ ਹੋ ਗਈਆਂ ਦਾਲ ਵਗੈਰਾ ਖਾਓ ਤੁਸੀਂ ਘਰ ਦੀ ਬਣੀ ਰੋਟੀ ਖਾਓ ਹਾ ਦਾਲ ਤੁਸੀਂ ਫਿਰ ਦਾਲ ਨਹੀਂ ਖਾਈ ਤੁਸੀਂ ਖਿੱਚੜੀ ਖਾਓ ਖਿੱਚੜੀ ਸਭ ਤੋਂ ਵਧੀਆ ਹੈ ਇਸ ਬਿਮਾਰੀਆਂ ਲਈ ਨਾ ਖਿਚੜੀ ਸਭ ਤੋਂ ਵਧੀਆ ਤੁਸੀਂ ਖਿਚੜੀ ਖਾਓ ਠੀਕ ਹੈ ਰੋਟੀ ਨਹੀਂ ਖਾਣੀ ਚਾਹੀਦੀ ਰੋਟੀ ਨਾ ਖਾਓ ਤੁਸੀਂ ਦੋ ਬਾਟੀਆਂ ਭਰ ਕੇ ਖਿਚੜੀ ਦੀ ਖਾ ਲਓ ਇਕੱਲੀ ਦਵਾਈ ਮੈਂ ਤੁਹਾਨੂੰ ਦੱਸਦਾ ਦੇਖੋ ਤੁਸੀਂ ਦਵਾਈ ਮੈਂ ਤੁਹਾਨੂੰ ਦੱਸਦਾ ਤੁਸੀਂ ਲਓ ਇੱਕ ਕੋਵਾਵੈਕਸੀਨ ਕਰਕੇ ਆਪਣੀ ਦਵਾਈ ਆਉਂਦੀ ਆ ਉਹ ਸਿਰਪ ਹੁੰਦਾ ਉਹ ਆਪਣੇ ਗਲੇ ਲਈ ਤੁਸੀਂ ਉਹ ਲੈ ਲਓ ਠੀਕ ਆ ਬਾਕੀ ਅਜ਼ਿਥਰੋਮਾਈਸੀਨ ਆਉਂਦੀ ਹੈ ਉਹ ਤੁਹਾਡੀ ਇਨਫੈਕਸ਼ਨ ਸਹੀ ਕਰ ਦੂਗੀ ਪੂਰੀ ਠੀਕ ਹੈ ਮੈਂ ਤੁਹਾਨੂੰ ਦੱਸਦਾ ਅਜ਼ਿਥਰੋਮਾਈਸੀਨ ਤੁਸੀਂ ਲਓ ਦਿਨ 'ਚ ਦੋ ਵਾਰ ਸਿਰਪ ਆਪਾਂ ਤਿੰਨ ਵਾਰ ਪੀਣਾ ਹੀ ਪੀਣਾ ਖਾਨੇ ਤੋਂ ਪਹਿਲਾਂ ਠੀਕ ਹੈ ਨਾ ਬਾਕੀ ਮੈਂ ਤੁਹਾਨੂੰ ਦਵਾਈ ਕੋਈ ਗੱਲ ਨਹੀਂ ਤੁਸੀਂ ਮੈਨੂੰ ਵਟਸ ਮੈਸੇਜ ਛੱਡ ਦਿਓ ਮੈਂ ਤੁਹਾਨੂੰ ਦਵਾਈ ਲਿਖ ਕੇ ਵੀ ਭੇਜ ਦਉਂਗਾ

ਹਾਂਜੀ ਉਹ ਕੋਈ ਗੱਲ ਨਹੀਂ ਉਹ ਮੌਸਮ ਦਾ ਹੈ ਮੈਂ ਤੁਹਾਨੂੰ ਦੱਸਦਾ ਤੁਸੀਂ ਇਥਰੋਮਾਈਸੀਨ ਕਰਕੇ ਕਰੀਮ ਆਉਂਦੀ ਆ ਠੀਕ ਹੈ ਤੁਸੀਂ ਉਹ ਲਾਓ ਥੋੜ੍ਹੇ ਦਿਨ ਉਹ ਆਪਣੇ ਆਪ ਦਾਨੇ ਸਹੀ ਹੋ ਜਾਣਗੇ ਉਹ ਮੌਸਮ ਤੁਹਾਨੂੰ ਪਤਾ ਗਰਮੀ ਸਰਦੀ ਦੇ ਮਿਕਸ ਜਿਹਾ ਮੌਸਮ ਹੈ ਨਾ ਉਹ ਇਸ ਕਰਕੇ ਚੱਲਦਾ ਪਿਆ ਉਹ ਕੋਈ ਵੱਡੀ ਟੈਂਸ਼ਨ ਲੈਣ ਵਾਲੀ ਗੱਲ ਨਹੀਂ ਹੈਗੀ ਠੀਕ ਆ ਆਪਾਂ ਸਭ ਤੋਂ ਜ਼ਿਆਦਾ ਆਪਾਂ ਜੋ ਧਿਆਨ ਰੱਖਣਾ ਉਹ ਆਪਣੀ ਖੁਰਾਕ ਦਾ ਧਿਆਨ ਰੱਖਣਾ ਠੀਕ ਹੈ ਬਾਕੀ ਤੁਸੀਂ ਬਿਲਕੁਲ ਨਿਸ਼ਚਿੰਤ ਰਹੋ ਕੋਈ ਵੀ ਚੱਕਰ ਹੋਵੇ ਤੁਸੀਂ ਮੈਨੂੰ ਕਾਲ ਕਰੋ ਕਿਸੇ ਵੀ ਟਾਈਮ ਠੀਕ ਆ ਧਿਆਨ ਰੱਖੋ ਜੀ ਠੀਕ ਹੈ ਜੀ ਚਲੋ ਚੰਗਾ ਜੀ ਓਕੇ